ਪੰਜਾਬ ਵਿੱਚ ਬੈਂਕਿੰਗ ਅਤੇ ਬੀਮਾ ਖੇਤਰ ਨੂੰ ਉੱਚ ਪ੍ਰਤੀਭਾ ਜਾਂ ਹੁਨਰ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਇਸ ਟਾਈਮ ਕਾਫੀ ਬੇਰੁਜ਼ਗਾਰੀ ਹੋਈ ਪਈ ਹੈ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ ਜਿਸ ਵਿੱਚ ਜਿੰਨੇ ਵਿਦਿਆਰਥੀ ਪੜ੍ਹੇ ਹਨ ਉਹਨਾਂ ਨੂੰ ਸਿੱਖਿਆ ਦਿੱਤੀ ਦੇ ਕੇ ਇਸ ਵਿੱਚ ਭਰਤੀ ਕੀਤਾ ਜਾ ਸਕਦਾ ਹੈ ਇਹਦੇ ਨਾਲ ਇੱਕ ਤਾਂ ਪੰਜਾਬ ਦੀ ਬੇਰੁਜ਼ਗਾਰੀ ਖਤਮ ਹੋਊਗੀ ਦੂਜਾ ਬੈਂਕਿੰਗ ਸੈਕਟਰ ਨੂੰ ਵੀ ਉਤਸਾਹਿਤ ਮਿਲੂਗੀ ਅਤੇ ਨਾਲ ਹੀ ਨਾਲ ਬੀਮਾ ਖੇਤਰ ਵਿੱਚ ਵੀ ਇਹਨਾਂ ਨੂੰ ਜੋਬ ਮਿਲੇ ਅਤੇ ਤਾਂ ਜੋ ਬੀਮਾ ਬੀਮਾ ਕੰਪਨੀਆਂ ਵੀ ਪ੍ਰੋਫਿਟ ਵੀ ਏ ਲਾ ਲਾਭਬੰਦ ਹੋਣ ਅਤੇ ਜਿਸ ਕਰਕੇ ਅਸੀਂ ਇਸ ਨੂੰ ਹੋਰ ਵੀ ਆਕਰਸ਼ਿਤ ਕਰਨ ਲਈ ਜਿਵੇਂ ਕਾਲਜਾਂ ਵਿੱਚੋਂ ਸਟੂਡੈਂਟ ਨੂੰ ਸਿੱਧਾ ਰੁਜ਼ਗਾਰ ਦੇ ਸਕਦੇ ਹਾਂ ਪਲੱਸ ਟੂ ਤੋਂ ਬਾਅਦ ਜਾਂ ਗਰੈਜੂ ਗਰੈਜੂਏਸ਼ਨ ਤੋਂ ਬਾਅਦ ਦੇ ਸਕਦੇ ਹਾਂ ਐਜੂਕੇਸ਼ਨ ਨਾਲ ਹੀ ਨਾਲ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਅਤੇ ਸਿੱਧੀ ਭਰਤੀ ਬੈਂਕ ਬੈਂਕ ਵਿੱਚ ਜਾਂ ਬੀਮਾ ਖੇਤਰ ਵਿੱਚ ਕਰ ਸਕਦੇ ਹਾਂ ਭਰਤੀ ਦੇ ਬਹੁਤ ਜ਼ਿਆਦਾ ਇਮਪਲੋਇਮੈਂਟ ਹੈ ਲੇਡੀਜ਼ ਜਿੱਦਾਂ ਬੈਂਕਿੰਗ ਖੇਤਰ ਵਾਸਤੇ ਕੁੜੀਆਂ ਨੂੰ ਜੋਬ ਵਧੀਆ ਰਹਿੰਦੀ ਹੈ ਅਤੇ ਬੀਮਾ ਖੇਤਰ ਵਿੱਚ ਜਾਂ ਫੀਲਡ ਦੀ ਫੀਲਡ ਦੇ ਖੇਤਰ ਵਿੱਚ ਮੁੰਡਿਆਂ ਨੂੰ ਜੋਬ ਵਧੀਆ ਮਿਲ ਸਕਦੀ ਹੈ ਇਹਦੇ ਵਿੱਚ ਅਤੇ ਉਹ ਆਪਣਾ ਰੁਜ਼ਗਾਰ ਚਲਾ ਸਕਦੇ ਹਨ